ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਫੰਡ ਦਿੱਤਾ ਜਾਂਦਾ ਹੈ ਉਨ੍ਹਾਂ ਦੀ ਲੋੜਮੰਦਾਂ ਦੇ ਅਨੁਸਾਰ ਜਿਵੇਂ ਕਿ ਜੇ ਉਹਨਾਂ ਨੇ ਸਕੂਲ 'ਚ ਲੈਬ ਪਾਉਣੀ ਹੈ ਲੈਬ ਚਾਲੂ ਕਰਨ ਲਈ ਲੈਬ ਲਈ ਥਾਂ ਚਾਹੀਦੀ ਆ ਲੈਬ ਵਿੱਚ ਇੰਸਟਰੂਮੈਂਟ ਚਾਹੀਦੇ ਆ ਠੀਕ ਇਸੀ ਤਰ੍ਹਾਂ 'ਚ ਕੰਪਿਊਟਰ ਲੈਬ ਹੁੰਦੀ ਆ ਕੰਪਿਊਟਰ ਲੈਬ ਨੂੰ ਵੀ ਤਾਂ ਥਾਂ ਚਾਹੀਦਾ ਹੈ ਫਿਰ ਕੰਪਿਊਟਰਸ ਵੀ ਚਾਹੀਦੇ ਆ ਤਾਂ ਕਈ ਵਾਰੀ ਸਕੂਲਾਂ ਕੋਲ ਥਾਂ ਤਾਂ ਹੁੰਦਾ ਆ ਮਗਰ ਕੰਪਿਊਟਰ ਨਹੀਂ ਤਾਂ ਉਹ ਕੰਪਿਊਟਰ ਲਈ ਡੀਮਾਂਡ ਕਰਦੀ ਹੈ ਸਰਕਾਰ ਨੂੰ ਕਿ ਵਈ ਸਾਨੂੰ ਫੰਡ ਦਓ ਤਾਂ ਕਿ ਸਾਡੇ ਨਿਆਣੇ ਕੰਪਿਊਟਰ ਸਿੱਖ ਸਕਣ ਠੀਕ ਇਸੀ ਤਰ੍ਹਾਂ ਸਕੂਲਾਂ ਕੋਲ ਗਰਾਉਂਡ ਤਾਂ ਨੇ ਮਗਰ ਗਰਾਊਂਡਸ ਲਈ ਬੱਚਿਆਂ ਨੂੰ ਖਲਾਉਣ ਲਈ ਜਿਹੜੇ ਇੰਸਟਰੂਮੈਂਟਸ ਨੇ ਇਕਓਪਮੈਂਟਸ ਨੇ ਉਹ ਨਹੀਂ ਹੁੰਦੇ ਨੇ ਤਾਂ ਫਿਰ ਗੌਰਮੈਂਟ ਉਹਨਾਂ ਨੂੰ ਇਕਓਪਮੈਂਟਸ ਦਿੰਦੀ ਹੈ ਠੀਕ ਇਸੇ ਤਰ੍ਹਾਂ ਫੰਡ ਦਿੰਦੀ ਆ ਫਿਰ ਇਸੇ ਤਰ੍ਹਾਂ ਜਿਵੇਂ ਕਿ ਜਿਹੜੀ ਆ ਸ਼ੂਟਿੰਗ ਰੇਂਜ ਹੁੰਦੀ ਆ ਹੁਣ ਪੰਜਾਬ ਸਰਕਾਰ ਨੇ ਵੀ ਕਈ ਜਗ੍ਹਾ 'ਤੇ ਸਕੂਲਾਂ 'ਤੇ ਸ਼ਪੈਸਲੀ ਪੈਸਾ ਦਿੱਤਾ ਹੈ ਕਿ ਤੁਸੀਂ ਸ਼ੂਟਿੰਗ ਰੇਂਜ ਕਰੀਏਟ ਕਰੋ ਤਾਂ ਅਸੀਂ ਤੁਹਾਨੂੰ ਉਹਦੇ ਲਈ ਫੰਡ ਦਿੰਦੇ ਆ ਔਰ ਇਹ ਲ ਕਈ ਕਈ ਲੱਖਾਂ 'ਚ ਹੁੰਦਾ ਫ਼ੰਡ ਜਿਹਦੇ ਨਾਲ ਕਿ ਉਹ ਸਕੂਲ ਨੂੰ ਅਤੇ ਉਸ ਸਕੂਲ ਦੇ ਬੱਚਿਆ ਨੂੰ ਵੀ ਫਾਇਦਾ ਹੁੰਦਾ ਹੈ